ਹੈਲੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਰ ਹਾਂਜੀ ਸਤਿ ਸ਼੍ਰੀ ਅਕਾਲ ਸਰ ਹਾਂਜੀ ਹਾਂਜੀ ਸਰ ਸਤਿ ਸ਼੍ਰੀ ਅਕਾਲ ਸਰ ਮੈਂ ਐਕਚੁਅਲੀ ਜੀ ਲੁਧਿਆਣੇ ਕਿਸੇ ਕੰਮ ਵਾਸਤੇ ਬਹੁਤ ਜ਼ਰੂਰੀ ਆਈ ਸੀ ਬਾਹਰੋਂ ਅਤੇ ਇੱਥੇ ਹੁਣ ਸਰ ਐਕਚੁਲੀ ਮੈਂ ਕਨਫਰਮ ਕਰਨਾ ਚਾਹੁੰਦੀ ਸੀਗੀ ਕਿ ਆਪਣੀਆਂ ਜਿਹੜੀ ਵੋਲਵੋ ਬਸ ਸਰਵਿਸ ਹੈਗੀ ਹੈ ਆਪਣੀ ਅਤੇ ਇਥੋਂ ਇਹ ਲੁਧਿਆਣਾ ਤੋਂ ਕਿਹੜੀਆਂ ਕਿਹੜੀਆਂ ਮੇਨ ਸਿਟੀਜ਼ ਨੇ ਜਿਹਨਾਂ ਨਾਲ ਇਹ ਅੱਗੇ ਕਨੈਕਟ ਕਰ ਸਕਦੀਆਂ ਜਿਹੜੀਆਂ ਮੇਜਰ ਸਿਟੀਜ਼ ਨੇ ਉਹਦੇ ਵਿੱਚ ਕਿੱਥੇ ਤੱਕ ਅਸੀਂ ਮਤਲਬ ਕਿਹੜੀ ਕਿਹੜੇ ਸ਼ਹਿਰ ਜਿਹੜੇ ਨੇ ਇੱਥੋਂ ਜ ਨਿਕਲਦੇ ਆ ਅਤੇ ਕਿਤੇ ਕਿਤੇ ਘੁੰਮ ਸਕਦੇ ਆ ਕਿਉਂਕਿ ਇਹਨਾਂ ਦੀ ਸਰਵਿਸ ਤੁਹਾਡੀ ਜੀ ਬੜੀ ਵਧੀਆ ਹੈਗੀ ਆ ਅਰਾਮ ਨਾਲ ਕੰਫੀਟੇਬਲ ਜਰਨੀ ਹੈ ਜਿੱਦਾਂ ਮਰਜ਼ੀ ਘੁੰਮ ਸਕਦੇ ਹੋ ਹਾਂਜੀ ਹਾਂਜੀ ਅੱਛਾ ਜੀ ਹਾਂਜੀ ਹਾਂਜੀ ਅੱਛਾ ਜੀ ਅੱਛਾ ਜੀ ਅੱਛਾ ਜੀ ਹਾਂਜੀ ਹਾਂਜੀ ਅੱਛਾ ਜੀ ਅੱਛਾ ਜੀ ਅੱਛਾ ਜੀ ਅੱਛਾ ਜੀ ਅੱਛਾ ਜੀ ਅੱਛਾ ਜੀ ਹਾਂਜੀ ਅੱਛਾ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਮ ਹਮ ਅੱਛਾ ਜੀ ਸਰ ਮੈਂ ਸੁਣਿਆ ਸੀ ਜਿਹੜਾ ਰਾਜਸਥਾਨ ਹੈਗਾ ਉਹ ਬੜੀ ਸੋਹਣੀ ਜਗ੍ਹਾ ਇੱਥੇ ਆਪਣੇ ਇੰਡੀਆ 'ਚ ਘੁੰਮਣ ਵਾਸਤੇ ਉੱਥੇ ਸਰ ਚਾਰ ਜਗ੍ਹਾ ਮੈਂ ਦੇਖ ਰਹੀ ਸੀਗੀ ਕਿ ਅਵੇਲੇਬਲ ਹੈਗੀਆਂ ਤੁਸੀਂ ਦੁਬਾਰਾ ਕਨਫਰਮ ਕਰੋਗੇ ਇੱਕ ਜਗ੍ਹਾ ਬੋਲ ਰਹੇ ਸੀ ਜੈਪੁਰ ਇੱਕ ਪਿਲਾਨੀ ਇੱਕ ਰਿੰਗਾਰ ਇੱਕ ਫਿਗਰ ਕਰਕੇ ਚਾਰ ਜਗ੍ਹਾ ਨੇ ਜਿੱਥੋਂ ਲੁਧਿਆਣਾ ਤੋਂ ਸਿੱਧੀਆਂ ਬਸਿਸ ਜਾਂਦੀਆਂ ਕੀ ਇਹ ਸਹੀ ਗੱਲ ਹੈ ਕਿ ਇਹ ਇੱਥੇ ਪਹੁੰਚਦੀਆਂ ਨੇ ਬੱਸਿਸ ਲੁਧਿਆਣਾ ਤੋਂ ਵੋਲਵੋ ਦੇ ਵਿੱਚ ਅੱਛਾ ਜੀ ਅੱਛਾ ਜੀ ਅੱਛਾ ਜੀ ਅੱਛਾ ਜੀ ਅੱਛਾ ਜੀ ਅੱਛਾ ਜੀ ਅੱਛਾ ਜੀ ਚਲੋ ਹਾਂਜੀ ਹਾਂਜੀ ਹਾਂਜੀ ਹਾਂਜੀ ਠੀਕ ਹੈ ਸਰ ਇਹ ਸਰ ਇਹ ਸਲਿਪਰ ਸਲਿਪਰ ਕਲਾਸ ਵੀ ਆਪਾਂ ਨੂੰ ਮਿਲ ਜਾਏਗੀ ਹਾਂਜੀ ਹਾਂਜੀ ਹਾਂਜੀ ਸਰ ਇਹਦਾ ਜਿਹੜਾ ਟਿਕਟ ਟਿਕਟ ਦਾ ਹਾਂਜੀ ਹਾਂਜੀ ਟਿਕਟ ਦਾ ਪ੍ਰਾਈਜ ਸੀ ਮੈਂ ਪੁੱਛਣ ਲੱਗੀ ਸੀ ਵੀ ਕੀ ਹੈਗਾ ਇਹਨਾਂ ਦਾ ਹਮ ਅੱਛਾ ਜੀ ਹਾਂਜੀ ਹਾਂਜੀ ਅੱਛਾ ਜੀ ਅੱਛਾ ਜੀ ਠੀਕ ਹੈ ਅੱਛਾ ਜੀ ਦਿੱਲੀ ਦਾ ਠੀਕ ਹੈ ਅੱਛਾ ਜੀ ਅੱਛਾ ਜੀ ਅੱਛਾ ਜੀ ਅੱਛਾ ਜੀ ਹਾਂ ਹਾਂ ਹਾਂ ਬਿਲਕੁਲ ਬਿਲਕੁਲ ਠੀਕ ਹੈ ਸਰ ਚਾਰ ਕ ਹਜ਼ਾਰ ਹਾਂਜੀ ਹਾਂਜੀ ਹਾਂਜੀ ਚਾਰ ਕ ਹਜ਼ਾਰ ਤੱਕ ਚਾਰ ਕ ਹਜ਼ਾਰ ਤੱਕ ਦੀ ਕੋਸਟ ਪੈ ਜਾਏਗੀ ਠੀਕ ਹੈ ਚਲੋ ਸਰ ਬਹੁਤ ਵਧੀਆ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਕੋਈ ਗੱਲ ਨਹੀਂ ਜੀ ਸਰ ਥੈਂਕ ਯੂ ਸੋ ਮੱਚ ਤੁਸੀਂ ਬਹੁਤ ਵਧੀਆ ਗਾਈਡ ਕਰ ਦਿੱਤਾ ਹੈਗਾ ਅਤੇ ਫਿਰ ਆਪਾਂ ਪਹੁੰਚ ਸਕਦੇ ਆਗੇ ਠੀਕ ਹੈ ਸਰ ਥੈਂਕ ਯੂ ਓਕੇ ਸਰ ਥੈਂਕ ਯੂ ਜੀ ਓਕੇ ਸਰ